ਇੱਕ ਜਨਵਰੀ ਦੋ ਹਜ਼ਾਰ ਪੰਜ ਅੱਠ ਫਰਵਰੀ ਦੋ ਹਜ਼ਾਰ ਅੱਠ ਅੱਠ ਦਸੰਬਰ ਦੋ ਹਜ਼ਾਰ ਸੋਲ੍ਹਾਂ ਚੌਦਾਂ ਮਾਰਚ ਦੋ ਹਜ਼ਾਰ ਅਠਾਸੀ ਅਠਾਰਾਂ ਜੂਨ ਉੱਨੀ ਸੌ ਨੜਿਨਵੇਂ